ਪੰਜਾਬ ਵਿੱਚ ਕੁਝ ਸਭ ਤੋਂ ਮਹੱਤਵਪੂਰਨ ਸੱਭਿਆਚਾਰਕ ਪਰੰਪਰਾ ਹਨ ਜਿਵੇਂ ਸਭ ਤੋਂ ਪਹਿਲਾਂ ਤੀਆਂ ਦਾ ਮੇਲਾ ਜਿਸ ਵਿੱਚ ਕੁੜੀਆਂ ਹਾਰ ਸ਼ਿੰਗਾਰ ਕਰਦੀਆਂ ਹਨ ਪੀਂਘਾਂ ਝੂਟਦੀਆਂ ਹਨ ਇਹ ਤਿਉਹਾਰ ਸਾਉਣ ਦੇ ਮਹੀਨੇ ਵਿੱਚ ਮਨਾਇਆ ਜਾਂਦਾ ਹੈ ਲੋ ਕੁੜੀਆਂ ਬਹੁਤ ਹੀ ਧੂਮਧਾਮ ਨਾਲ ਇਹ ਤਿਉਹਾਰ ਮਨਾਉਂਦੀਆਂ ਹਨ ਅਤੇ ਕਈ ਪਰੰਪਰਾਵਾਂ ਨਿਭਾਉਂਦੀਆਂ ਹਨ ਇਸ ਤੋਂ ਇਲਾਵਾ ਜਰਗ ਦਾ ਮੇਲਾ ਜਿੱਥੇ ਕਈ ਤਰ੍ਹਾਂ ਦੀਆਂ ਸਟਾਲਾਂ ਲੱਗਦੀਆਂ ਹਨ ਸਾਨੂੰ ਬਹੁਤ ਕੁਝ ਦੇਖਣ ਨੂੰ ਮਿਲਦਾ ਹੈ ਕਲਾ ਕਈ ਤਰ੍ਹਾਂ ਦੀਆਂ ਕਲਾ ਦਿਖਾਈਆਂ ਜਾਂਦੀਆਂ ਹਨ ਲੋਕ ਬਹੁਤ ਹੀ ਧੂਮਧਾਮ ਨਾਲ ਇਸ ਮੇਲੇ 'ਤੇ ਆਉਂਦੇ ਹਨ ਇਸ ਤੋਂ ਇਲਾਵਾ ਯੂਥ ਫੈਸਟੀਵਲ ਯੁਵਕ ਮੇਲਾ ਜੋ ਕਿ ਕਾਲਜਾਂ ਯੂਨੀਵਰਸਿਟੀਆਂ ਵਿੱਚ ਮਨਾਇਆ ਜਾਂਦਾ ਹੈ ਇਹ ਸਾਲ ਵਿੱਚ ਇੱਕ ਵਾਰ ਮਨਾਇਆ ਜਾਂਦਾ ਹੈ ਜਿਸ ਵਿੱਚ ਕਈ ਵਿਦਿਆਰਥੀ ਭਾਗ ਲੈਂਦੇ ਹਨ ਅਤੇ ਕਈ ਆਪਣੀਆਂ ਆਪਣੀ ਕਲਾ ਦਾ ਪ੍ਰਦਰਸ਼ਨ ਕਰਦੇ ਹਨ ਨ ਕੁੜੀਆਂ ਗਿੱਧੇ ਵਿੱਚ ਗਿੱਧੇ ਅਤੇ ਮੁੰਡੇ ਭੰਗੜਾ ਕਰਦੇ ਹਨ ਇਸ ਤੋਂ ਇਲਾਵਾ ਰੀਤੀ ਰਿਵਾਜ ਵੀ ਨਿਭਾਏ ਜਾਂਦੇ ਹਨ ਰੀਤੀ ਰਿਵਾਜ ਵਿੱਚ ਜਿਵੇਂ ਕਿ ਵਿਆਹ ਵ ਵਿਆਹ ਦੇ ਸਮੇਂ ਇੱਕ ਦਿਨ ਪਹਿਲਾਂ ਕੁੜੀ ਦੇ ਵਟਣਾ ਲਗਾਇਆ ਜਾਂਦਾ ਹੈ ਸੰਗੀਤ ਕੀਤਾ ਜਾਂਦਾ ਹੈ ਅਤੇ ਤ ਵਿਆਹ ਵਾਲੇ ਦਿਨ ਜਦੋਂ ਮੁੰਡਾ ਕੁੜੀ ਨੂੰ ਵਿਆਹ ਕੇ ਘਰ ਲਿਆਉਂਦਾ ਹੈ ਤਾਂ ਮਾਂ ਪਾਣੀ ਵਾਰ ਕੇ ਪੀਂਦੀ ਹੈ ਗੇਟ 'ਤੇ ਤੇਲ ਚੋਂਦੀ ਹੈ ਇਸ ਤਰ੍ਹਾਂ ਕਈ ਤਰ੍ਹਾਂ ਦੇ ਰੀਤੀ ਰਿਵਾਜ ਨਿਭਾਏ ਜਾਂਦੇ ਹਨ